ਮੈਂ ਅਕਸਰ ਹੀ ਤਿਉਹਾਰਾਂ ਦੇ ਮੌਕੇ ਬਹੁਤ ਸਾਰੀਆਂ ਮੂਰਤੀਆਂ ਬਣਾਉਂਦੀ ਰਹਿੰਦੀ ਹਾਂ ਵੈਸੇ ਪੰਜਾਬ ਦੇ ਵਿੱਚ ਨਰਾਤਿਆਂ ਦੇ ਸਮੇਂ ਇੱਕ ਸਾਂਝੀ ਮਾਤਾ ਦੀ ਮੂਰਤੀ ਬਣਾਈ ਜਾਂਦੀ ਹੈ ਇਹ ਮੂਰਤੀ ਮਿੱਟੀ ਦੀ ਬਣਾਈ ਜਾਂਦੀ ਹੈ ਮਿੱਟੀ ਦੀ ਮੂਰਤੀ ਬਣਾ ਕੇ ਇਸ ਨੂੰ ਪੇਂਟ ਕੀਤਾ ਜਾਂਦਾ ਕਲੀ ਦੇ ਨਾਲ ਫਿਰ ਇਸ ਨੂੰ ਤਾਰਿਆਂ ਦੇ ਨਾਲ ਬਹੁਤ ਹੀ ਸੋਹਣਾ ਸਜਾਇਆ ਜਾਂਦਾ ਇਸ ਨੂੰ ਸਜਾਉਣ ਤੋਂ ਬਾਅਦ ਇੱਕ ਕੰਧ ਦੇ ਉੱਤੇ ਲਗਾ ਦਿੱਤਾ ਜਾਂਦਾ ਅਤੇ ਇਸ ਨੂੰ ਵੱਖ ਵੱਖ ਗਹਿਣਿਆਂ ਦੇ ਨਾਲ ਵੀ ਸ਼ਿੰਗਾਰਿਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਮੈਂ ਦਿਵਾਲੀ ਦੇ ਸਮੇਂ ਬਹੁਤ ਸਾਰੇ ਦੀਵੇ ਬਣਾਏ ਸੀਗੇ ਮਿੱਟੀ ਦੇ ਅਤੇ ਉਹਨਾਂ ਨੂੰ ਮੈਂ ਬਹੁਤ ਵਧੀਆ ਕਲਰ ਕੀਤਾ ਕਲਰ ਕਰਕੇ ਉਹਨਾਂ ਦੇ ਉੱਤੇ ਬਹੁਤ ਸਾਣੇ ਸਾਰੇ ਡਿਜ਼ਾਈਨ ਬਣਾਏ ਜਿਵੇਂ ਛੋਟੇ ਛੋਟੇ ਤਾਰੇ ਬਜ਼ਾਰ ਵਿੱਚੋਂ ਮਿਲ ਜਾਂਦੇ ਹਨ ਸਟਾਰਸ ਉਹ ਲਗਾ ਕੇ ਸੁ ਸੁਨਹਿਰੀ ਕਲਰ ਦੇ ਰੱਖ ਦਿੱਤੇ ਤਾਂ ਉਹ ਬਹੁਤ ਸੋਹਣੇ ਅ ਅੱਖਾਂ ਨੂੰ ਅਟਰੈਕਟ ਕਰਦੇ ਸੀਗੇ ਅਤੇ ਇਹ ਅਨੁਭਵ ਮੇਰਾ ਬਹੁਤ ਜ਼ਿਆਦਾ ਵਧੀਆ ਰਿਹਾ ਸਭ ਪੁੱਛ ਰਹੇ ਸੀ ਵੀ ਤੂੰ ਕਿਵੇਂ ਬਣਾਏ ਜਾਂ ਕਿੱਥੋਂ ਲੈ ਕੇ ਆਈ ਤਾਂ ਮੈਂ ਉਹਨਾਂ ਨੂੰ ਦੱਸਿਆ ਮੈਂ ਖੁਦ ਬਣਾਏ ਨੇ ਤਾਂ ਮੈਨੂੰ ਬਹੁਤ ਵਧੀਆ ਫੀਲ ਹੋਇਆ ਕਿ ਮੇਰੇ ਹੱਥ ਵਿੱਚ ਵੀ ਇਹੋ ਜਿਹੀ ਕਲਾ ਹੈ ਕਿ ਮੈਂ ਬਹੁਤ ਸਾਣ ਸਾਰੀਆਂ ਸੋਹਣੀਆਂ ਮੂਰਤੀਆਂ ਬਣਾ ਲੈਂਦੀ ਹਾਂ